ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀਗੀ ਹਾਂਜੀ ਭਾਅ ਜੀ ਮੈਂ ਰੇਲਵੇ ਸਟੇਸ਼ਨ ਤੋਂ ਲੈ ਕੇ ਤੇ ਗੋਲਡਨ ਗੇਟ ਤੱਕ ਜਾਣਾ ਸੀਗਾ ਹਾਂਜੀ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਮੈਂ ਇਸ ਟਾਈਮ 'ਤੇ ਰੇਲਵੇ ਸਟੇਸ਼ਨ ਕੋਲ ਖੜ੍ਹੀ ਹਾਂ ਤੁਹਾਡੀ ਲੋਕੇਸ਼ਨ ਕਿੱਥੇ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਅੱਛਾ ਅੱਛਾ ਸ ਭਾਅ ਜੀ ਮੈਂ ਬਿਲਕੁਲ ਹੀ ਐਂਟਰੀ 'ਤੇ ਖੜ੍ਹੀ ਹਾਂ ਤੁਸੀਂ ਕਿੱਥੇ ਹੋ ਅੱਛਾ ਅੱਛਾ ਤੁਸੀਂ ਐਗਜਿਟ ਗੇਟ 'ਤੇ ਖੜ੍ਹੇ ਹੋ ਅਤੇ ਭਾਅ ਜੀ ਤੁਸੀਂ ਉੱਧਰੋਂ ਦੀ ਘੁੰਮ ਕੇ ਐਂਟਰੀ ਗੇਟ 'ਤੇ ਆ ਜਾਓ ਹਾਂਜੀ ਹਾਂਜੀ ਭਾਅ ਜੀ ਪਿੱਛੋਂ ਦੀ ਘੁੰਮ ਕੇ ਆਉਣਾ ਤੁਹਾਨੂੰ ਅੱਗੋਂ ਦੀ ਚਲਾਨ ਹੋ ਸਕਦਾ ਆ ਹਾਂਜੀ ਹਾਂਜੀ ਭਾਅ ਜੀ ਕੋਈ ਨਾ ਆ ਜਾਓ ਅੱਛਾ ਕੋਈ ਨਹੀਂ ਐਕਸਟਰਾ ਪੇਮੈਂਟ ਹੈ ਮੈਂ ਦੇ ਦਾਂਗੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਅੱਛਾ ਅੱਛਾ ਅਤੇ ਤੁਸੀਂ ਉੱਧਰੋਂ ਦੀ ਘੁੰਮ ਕੇ ਅਗਲੇ ਗੇਟ 'ਤੇ ਐਂਟਰੀ ਗੇਟ 'ਤੇ ਆ ਜਾਓ ਮੈਂ ਬਿਲਕੁਲ ਹੀ ਐਂਟਰੀ 'ਤੇ ਖੜ੍ਹੀ ਹਾਂ ਹਾਂਜੀ ਹਾਂਜੀ ਭਾਅ ਜੀ ਅਤੇ ਥੋੜ੍ਹਾ ਜਲਦੀ ਕਰ ਦਿਉ ਮੇਰੀ ਬਹੁਤ ਜ਼ਰੂਰੀ ਮੀਟਿੰਗ ਹੈ ਮੈਂ ਜਾਣਾ ਆ ਥੋੜ੍ਹਾ ਜਲਦੀ ਆ ਸਕਦੇ ਹੋ ਤਾਂ ਬਿਲਕੁਲ ਜਲਦੀ ਆ ਜਾਓ ਧੰਨਵਾਦ